ਮੈਨੂੰ ਅੱਜ ਇਹ ਦੱਸਦਿਆਂ ਹੋਇਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਮੈਂ ਟੈਨਥ ਕਲਾਸ ਵਿੱਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਵਿੱ ਵੱਲੋਂ ਸਾਨੂੰ ਇੱਕ ਐਗਜੀਬਿਸ਼ਨ 'ਤੇ ਖੜਿਆ ਗਿਆ ਉਸ ਐਗਜੀਬਿਸ਼ਨ ਦੇ ਦੌਰਾਨ ਅਸੀਂ ਕਪੂਰਥਲਾ ਸਾਇੰਸ ਸਿਟੀ ਗਏ ਸੀ ਜੋ ਕਿ ਇੱਕ ਬਹੁਤ ਹੀ ਵਧੀਆ ਸਾਇੰਸ ਸਿਟੀ ਹੈ ਉਸ ਸਾਇੰਸ ਸਿਟੀ ਦਾ ਨਾਮ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਹੈ ਅਤੇ ਉੱਥੇ ਕਾਫੀ ਸਾਰੇ ਥਿਏਟਰ ਵੀ ਹਨ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਗਲੋਬ ਥਿਏਟਰ ਅਤੇ ਇੱਕ ਡਾਇਨਾਸੋਰ ਥਿਏਟਰ ਦੇ ਵਿੱਚ ਗਏ ਸਾਂ ਗਲੋਬ ਥਿਏਟਰ ਦੇ ਵਿੱਚ ਸਾਨੂੰ ਪੁਰਾਣੀਆਂ ਫਿਲਮਾਂ ਦਿਖਾਈਆਂ ਗਈਆਂ ਸੀ ਅਸੀਂ ਇਸ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਸਾਡਾ ਪੁਰਾਣਾ ਸੱਭਿਆਚਾਰ ਅੱਜ ਦੇ ਸੱਭਿਆਚਾਰ ਨਾਲੋਂ ਖਾਸ ਹੈ ਵਧੀਆ ਹੈ ਅਤੇ ਅਨੋਖਾ ਹੈ ਅਤੇ ਡਾਇਨਾਸੋਰ ਥਿਏਟਰ ਦੇ ਵਿੱਚ ਸਾਨੂੰ ਡਾਇਨਾਸੋਰ ਦੀਆਂ ਫਿਲਮਾਂ ਦਿਖਾਈਆਂ ਗਈਆਂ ਸਨ ਅਤੇ ਉਹਨਾਂ ਬਾਰੇ ਦੱਸਿਆ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਾਇਨਾਸੋਰ ਨੂੰ ਦੇਖਣਾ ਬਹੁਤ ਹੀ ਮੁਸ਼ਕਲ ਹੋਵੇਗਾ ਜੋ ਕਿ ਅੱਜ ਸੱਚ ਹੋ ਰਿਹਾ ਹੈ ਇਸ ਤੋਂ ਬਾਅਦ ਜਦੋਂ ਅਸੀਂ ਟਵੈਲਥ ਦੇ ਵਿੱਚ ਹੋਏ ਤਾਂ ਸਾਡੇ ਸਕੂਲ ਵੱਲੋਂ ਸਾਨੂੰ ਗਲੋਬਲ ਗਰੁੱਪ ਆਫ ਇੰਸਟੀਟਿਊਟ ਜੋ ਕਿ ਅੰਮ੍ਰਿਤਸਰ ਵਿੱਚ ਹੈ ਉੱਥੇ ਐਗਜੀਬਿਸ਼ਨ ਸੀ ਤਾਂ ਸਾਨੂੰ ਖੜਿਆ ਗਿਆ ਉਸ ਐਗਜੀਬਿਸ਼ਨ ਦੇ ਵਿੱਚ ਸਾਨੂੰ ਗਲੋਬਲ ਗਰੁੱਪ ਆਫ ਇੰਸਟੀਟਿਊਟ ਦੇ ਟੀਚਰਸ ਅਤੇ ਪ੍ਰਿੰਸੀਪਲ ਨੇ ਇਹ ਦੱਸਿਆ ਕਿ ਕਿਵੇਂ ਉਹਨਾਂ ਦਾ ਇੰਸਟੀਟਿਊਟ ਕਿਵੇਂ ਉਹਨਾਂ ਦੇ ਇੰਸਟੀਟਿਊਟ ਦੇ ਵਿੱਚ ਡਿਸਿਪਲਨ ਪੜ੍ਹਾਈ ਅਤੇ ਸਫਾਈ ਰਹਿੰਦੀ ਹੈ ਉੱਥੇ ਕਾਫੀ ਸਾਰੇ ਐਗਜੀਬਿਸ਼ਨ ਲਗਾਏ ਹੋਏ ਸੀ ਬੱਚਿਆਂ ਦੁਆਰਾ ਜਿਨ੍ਹਾਂ ਐਗਜੀਬਿਸ਼ਨਾਂ ਦੇ ਵਿੱਚੋਂ ਮੈਨੂੰ ਯਾਦ ਹੈ ਕਿ ਉੱਥੇ ਇੱਕ ਫੁੱਲਾਂ ਦਾ ਐਗਜੀਬਿਸ਼ਨ ਸੀ ਖਾਣ ਪੀਣ ਦਾ ਐਗਜੀਬਿਸ਼ਨ ਅਤੇ ਗੇਮਾਂ ਖੇਡਣ ਦਾ ਐਗਜੀਬਿਸ਼ਨ ਸੀ ਸਾਨੂੰ ਉੱਥੇ ਜਾ ਕੇ ਕਾਫੀ ਮਜ਼ਾ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਵੈਲਥ ਤੋਂ ਬਾਅਦ ਦਾ ਟਾਈਮ ਬਹੁਤ ਹੀ ਡਿਫੀਕਲਟ ਹੁੰਦਾ ਹਰੇਕ ਬੱਚੇ ਦੇ ਲਈ ਪਰ ਜਦੋਂ ਅਸੀਂ ਉਸ ਇੰਸਟੀਚਿਊਟ ਵਿੱਚ ਗਏ ਤਾਂ ਸਾਨੂੰ ਉਸ ਇੰਸਟੀਚਿਊਟ ਵਾਲੇ ਅਧਿਆਪਕਾਂ ਨੇ ਐਨਾ ਸਹੀ ਤਰ੍ਹਾਂ ਰਸਤਾ ਦਿਖਾਇਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹਾਂ ਕੀ ਬਣਨਾ ਚਾਹੁੰਦੇ ਹਾਂ ਅਤੇ ਕਿਉਂ ਅਤੇ ਅੱਜ ਉਹਨਾਂ ਦੇ ਦਰਸ਼ ਦਿਖਾਏ ਹੋਏ ਮਾਰਗ ਦੇ ਉੱਤੇ ਚੱਲਦਿਆਂ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ